ਜਿਉਂ ਜਿਉਂ ਆਵਾਜਾਈ ਵੱਧ ਰਹੀ ਹੈ ਉਵੇਂ ਹੀ ਸੜਕਾਂ ਉੱਤੇ ਟ੍ਰੈਫਿਕ ਵੱਧ ਰਹੀ ਹਨ ਜਦੋਂ ਵੀ ਅਸੀਂ ਕੋਈ ਕੰਮ ਲਈ ਘਰੋਂ ਨਿਕਲਦੇ ਹਨ ਤਾਂ ਮੋਹਾਲੀ ਦੇ ਰਸਤਿਆਂ ਵਿੱਚ ਟ੍ਰੈਫਿਕ ਜਾਮ ਹੁੰਦਾ ਹੈ ਜਿਸ ਟ੍ਰੈਫਿਕ ਜਾਮ ਹੋਣ ਨਾਲ ਹਰ ਬੰਦਾ ਹਰ ਵਿਅਕਤੀ ਆਪਣੇ ਕੰਮ ਤੋਂ ਲੇਟ ਹੋ ਜਾਂਦਾ ਹੈ ਅਤੇ ਕਈ ਵਾਰੀ ਟ੍ਰੈਫਿਕ ਦੇ ਕਾਰਨ ਇੱਕ ਦੂਸਰੇ ਆਪਸ ਵਿੱਚ ਝੜਪ ਵੀ ਹੋ ਜਾਂਦੀ ਹਨ ਅਤੇ ਗਾਲਮ ਗਲੋਚੀ ਕਰਨ ਲੱਗ ਜਾਂਦੇ ਹਨ ਲੋਕ ਜਿਸ ਕਰਕੇ ਕਾਫੀ ਸੰਤੁਲਿਤ ਵਿਗੜਦਾ ਹੈ ਇਸ ਲਈ ਮੇਰੀ ਮੰਗ ਇਹ ਹੀ ਹੈ ਕਿ ਸਰਕਾਰ ਵੱਲੋਂ ਕਿ ਉਹ ਲਿਮਿਟਡ ਹੀ ਆਵਾਜਾਈ ਨੂੰ ਅੱਗੇ ਵਧਾਏ ਤਾਂ ਇਹ ਲੋਕ ਇੱਕ ਬੰਦਾ ਇੱਕ ਕਾਰ ਦੀ ਬਜਾਏ ਇੱਕ ਚਾਰ ਬੰਦੇ ਇੱਕ ਕਾਰ ਵਿੱਚ ਜਾਣ ਤਾਂ ਕਿ ਟ੍ਰੈਫਿਕ ਵੀ ਘਟੇ ਅਤੇ ਲੋਕਾਂ ਨੂੰ ਪਹੁੰਚਣ ਲੱਗੇ ਟ੍ਰੈਫਿਕ ਘਟੇ ਅਤੇ ਲੋਕਾਂ ਟਾਈਮ ਨਾਲ ਪਹੁੰਚ ਜਾਣ